ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਮੈਂ ਤੁਹਾਨੂੰ ਕੈਬ ਬੁੱਕ ਕੀਤੀ ਸੀਗੀ ਅਤੇ ਤੁਹਾਨੂੰ ਅੱਠ ਵਜੇ ਦਾ ਟਾਈਮ ਦਿੱਤਾ ਸੀਗਾ ਮੈਂ ਚੰਡੀਗੜ੍ਹ ਏਅਰਪੋਰਟ 'ਤੇ ਟਾਈਮ 'ਤੇ ਪਹੁੰਚਣਾ ਸੀ ਮੇਰੀ ਫਲਾਈਟ ਨਾ ਮਿਸ ਹੋ ਜਾਵੇ ਅਤੇ ਤੁਸੀਂ ਹੁਣ ਇੱਕ ਘੰਟਾ ਲੇਟ ਹੋ ਗਏ ਓਂ ਅਤੇ ਹੁਣ ਪਲੀਜ਼ ਕਿਰਪਾ ਕਰਕੇ ਤੁਸੀਂ ਛੇਤੀ ਟਾਈਮ 'ਤੇ ਆ ਸਕਦੇ ਓਂ ਤਾਂ ਜੋ ਮੈਂ ਆਪਣੀ ਫਲਾਈਟ ਟਾਈਮ 'ਤੇ ਲੈ ਸਕਾਂ ਅਤੇ ਮੈਨੂੰ ਹੁਣ ਆਪਣਾ ਕਾਰਨ ਨਾ ਦੱਸਿਓ ਮੈਂ ਟਾਈਮ 'ਤੇ ਪਹੁੰਚਣਾ ਚਾਹੁੰਦੀ ਹਾਂ ਮੇਰੀ ਫਲਾਈਟ ਸੀਗੀ ਬਾਰ੍ਹਾਂ ਵਜੇ ਦੀ ਅਤੇ ਹੁਣ ਵੀ ਮੈਂ ਟਾਈਮ 'ਤੇ ਪਹੁੰਚ ਸਕਦੀ ਹਾਂ ਜੇ ਤੁਸੀਂ ਅੱਧੇ ਘੰਟੇ 'ਚ ਮੈਨੂੰ ਲੈਣ ਆ ਜਾਓ